ਵੈਸੇ ਤਾਂ ਮੈਨੂੰ ਹਰ ਪੰਛੀ ਪਸੰਦ ਹੈ ਪਰ ਮੈਨੂੰ ਤੋਤਾ ਅਤੇ ਮੋਰ ਜ਼ਿਆਦਾ ਪਸੰਦ ਨੇ ਕਿਉਂਕਿ ਇਹ ਮੈਂ ਬਚਪਨ ਵਿੱਚ ਵੀ ਇਨ੍ਹਾਂ ਤੋਤਿਆਂ ਨੂੰ ਦੇਖਿਆ ਸੀ ਇਹਦਾ ਹਰਾ ਰੰਗ ਹੁੰਦਾ ਹੈ ਅਤੇ ਇਹਦੀ ਚੁੰਝ ਲਾਲ ਹੁੰਦੀ ਹੈ ਅਤੇ ਇਹਦੀ ਬੋਲੀ ਬਹੁਤ ਸੋਹਣੀ ਹੁੰਦੀ ਹੈ ਕਰ ਕਰਦਾ ਹੈ ਅਤੇ ਇਹ ਮੈਨੂੰ ਬੜਾ ਪਸੰਦ ਸੀ ਬੜਾ ਘਰ ਦੇ ਬਾਹਰ ਇਹਨੇ ਫਿਰਨਾ ਅਤੇ ਮੈਂ ਦੇਖਣਾ ਹੁਣ ਵੀ ਕਦੀ ਕਦੀ ਨਜ਼ਰ ਆ ਜਾਂਦਾ ਹੈ ਅਤੇ ਜਿਹੜਾ ਜਿਹੜਾ ਕਿ ਮੋਰ ਹੈ ਉਹ ਮੈਂ ਆਪਣੇ ਪਰਿਵਾਰ ਨਾਲ ਰਾਜਸਥਾਨ ਜਦ ਗਈ ਤਾਂ ਮੇਰਾ ਬੜਾ ਸ਼ੌਕ ਸੀ ਮੈਂ ਦੇਖਾਂ ਇਹਨੂੰ ਅਤੇ ਦੇਖਿਆ ਇਹਦੇ ਮੈਨੂੰ ਮੋਰ ਦੇ ਪੰਖ ਬਹੁਤ ਸੋਹਣੇ ਲੱਗਦੇ ਹਨ ਇਹਦੇ ਨੀਲੇ ਹਰੇ ਰੰਗ ਦੇ ਇਨ੍ਹਾਂ ਦੇ ਪੰਖ ਹੁੰਦੇ ਹਨ ਅਤੇ ਬਹੁਤ ਵਧੀਆ ਵਧੀਆ ਲੱਗਦੇ ਹਨ ਇਹ ਜਦੋਂ ਫੈਲਾਉਂਦੇ ਹਨ ਤਾਂ ਮਨ ਖੁਸ਼ ਹੋ ਜਾਂਦਾ ਹੈ ਅਤੇ ਇਹ ਜਿਹੜੇ ਨੇ ਪੰਛੀ ਦਿਲ ਨੂੰ ਭਾਉਂਦੇ ਹਨ ਇਨ੍ਹਾਂ ਨੂੰ ਦੇਖ ਕੇ ਬੰਦੇ ਨੂੰ ਆਪਣੇ ਗੁਰੂਆਂ ਪੀਰਾਂ ਦੀ ਵੀ ਯਾਦ ਆ ਜਾਂਦੀ ਹੈ ਜਿਹੜੇ ਕਿ ਆਪਣੇ ਪਰਮਾਤਮਾ ਦੀ ਵੀ ਇਨ੍ਹਾਂ ਨੂੰ ਯਾਦ ਆਉਂਦੀ ਰਹਿੰਦੀ ਹੈ ਜਿਹੜੇ ਇਨ੍ਹਾਂ ਨੂੰ ਸਿਰ ਸੁੱਟ ਕੇ ਚਿੜੀਆਂ ਦੇਖੋ ਤੋਤੇ ਦੇਖੋ ਇਹਨਾਂ ਨੂੰ ਦੇਖਦੇ ਹਾਂ ਜਿਸ ਵੇਲੇ ਕਬੂਤਰਾਂ ਨੂੰ ਦੇਖਦੇ ਹਾਂ ਇਹਨਾਂ ਨੂੰ ਦੇਖਦੇ ਹਾਂ ਸਵੇਰੇ ਉੱਠ ਕੇ ਸੈਰ ਕਰਦੇ ਹਾਂ ਅਤੇ ਇਨ੍ਹਾਂ ਨੂੰ ਬੜਾ ਮਨ ਖੁਸ਼ ਹੁੰਦਾ ਹੈ ਅਤੇ ਮਨ ਖੁਸ਼ ਹੋਣ ਨਾਲ ਸਾਡਾ ਮਨ ਖੁਸ਼ ਹੋਣ ਨਾਲ ਇਨ੍ਹਾਂ ਇਨ੍ਹਾਂ ਨੂੰ ਦੇਖਦੇ ਦੇਖਦੇ ਅਸੀਂ ਪਰਮਾਤਮਾ ਨਾਲ ਵੀ ਜੁੜ ਜਾਂਦੇ ਹਾਂ ਅਤੇ ਇਹ ਜਿਹੜੇ ਨੇ ਇਹ ਸਾਡੇ ਮਨ ਨੂੰ ਬਹੁਤ ਭਾਉਂਦੇ ਹਨ ਇਹ ਜਿਹੜੇ ਨੇ ਸਾਡੀ ਸਾਡੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਨੇ ਜਿਹੜੇ ਕਿ ਇਹ ਹਿੱਸਾ ਨੇ ਕਿਉਂਕਿ ਇਨ੍ਹਾਂ ਨੂੰ ਅਸੀਂ ਦੇਖਣਾ ਔਰ ਇਨ੍ਹਾਂ ਨਾਲ ਇਨ੍ਹਾਂ ਨਾਲ ਦੋ ਮਿੰਟ ਇਨ੍ਹਾਂ ਨਾਲ ਖੜ੍ਹੇ ਹੋ ਕੇ ਇਨ੍ਹਾਂ ਨਾਲ ਗੱਲਾਂ ਬਾਤਾਂ ਕਰਨੀਆਂ ਇਹ ਸਾਡੇ ਜੀਵਨ ਦਾ ਇੱਕ ਲਕਸ਼ਯ ਹੈ ਕਿਉਂਕਿ ਇਹ ਸਾਨੂੰ ਬਹੁਤ ਜੀਵਨ ਦੀ ਲੋੜ ਹੈ ਧੰਨਵਾਦ ਜੀ